ਸਤਿ ਸ਼੍ਰੀ ਅਕਾਲ ਜੀ ਤੁਸੀਂ ਸਿਮਰਨ ਦੀ ਮੰਮਾ ਬੋਲ ਰਹੇ ਹੋ ਹਾਂਜੀ ਸਿਮਰਨ ਦੀ ਨਾ ਸਵੇਰ ਤੋਂ ਤਬੀਅਤ ਬਹੁਤ ਜ਼ਿਆਦਾ ਖਰਾਬ ਹੈ ਉਹ ਸਵੇਰ ਤੋਂ ਹੀ ਵੋਮਟਿੰਗ ਕਰ ਰਹੀ ਹੈ ਅਤੇ ਅਸੀਂ ਉਹਨੂੰ ਮੈਡੀਸਨ ਦੇ ਕੇ ਥੋੜ੍ਹੀ ਰੈਸਟ ਕਰਨ ਲਈ ਕਿਹਾ ਸੀ ਬਟ ਹੁਣ ਉਹਦੀ ਤਬੀਅਤ ਨਾ ਜ਼ਿਆਦਾ ਖਰਾਬ ਹੋ ਰਹੀ ਹੈ ਹੁਣ ਉਹਨੂੰ ਨਾਲ ਲੂਜ ਮੋਸ਼ਨਜ਼ ਵੀ ਲੱਗ ਗਏ ਨੇ ਹਾਂਜੀ ਅਤੇ ਕਿਰਪਾ ਕਰਕੇ ਤੁਸੀਂ ਸਕੂਲ ਆ ਕੇ ਉਹਨੂੰ ਲੈ ਜਾਉ ਹਾਂਜੀ ਹਾਂਜੀ ਮੈਮ ਕੋਈ ਗੱਲ ਨਹੀਂ ਅਸੀਂ ਉਹਨੂੰ ਜੂਸ ਵਗੈਰਾ ਪਿਆ ਦਿੰਦੇ ਹਾਂ ਤੁਸੀਂ ਜਿੰਨੀ ਜਲਦੀ ਹੋ ਸਕੇ ਉਹਨੂੰ ਆ ਕੇ ਲੈ ਜਾਉ ਓਕੇ ਜੀ ਧਨ ਧੰਨਵਾਦ ਜੀ ਧੰਨਵਾਦ